ਅਕਾਸ਼ੀ ਘਟਨਾ ਅਕਾਸ਼ੀ ਘਟਨਾ ਤੋਂ ਭਾਵ ਖੁੱਲ੍ਹੇ ਅਸਮਾਨ ਦੇ ਵਿੱਚ ਰਾਤ ਨੂੰ ਜਿਵੇਂ ਕਿਸੇ ਤਾਰੇ ਦਾ ਟੁੱਟਣਾ ਜਾਂ ਸੂਰਜ ਗ੍ਰਹਿਣ ਜਾਂ ਚੰਨ ਗ੍ਰਹਿਣ ਦਾ ਲੱਗਣਾ ਅਸਮਾਨ ਦੇ ਵਿੱਚ ਜੋ ਵੀ ਘਟਨਾ ਘਟਦੀ ਹੈ ਜਾਂ ਇਸ ਤੋਂ ਇਲਾਵਾ ਵਰਖਾ ਦੇ ਟਾਈਮ ਜੋ ਵੀ ਅਸਮਾਨੀ ਬਿਜਲੀ ਅਸਮਾਨ ਵਿੱਚ ਲਿਸ਼ਕਦੀ ਜਾਂ ਗਰਜਦੀ ਹੈ ਅਤੇ ਬੱਦਲ ਗਰਜਦੇ ਹਨ ਇਹ ਸਭ ਅਕਾਸ਼ੀ ਘਟਨਾ ਦੇ ਨਾਲ ਸੰਬੰਧਿਤ ਹਨ ਇਸ ਤੋਂ ਇਲਾਵਾ ਅਸਮਾਨ ਦੇ ਵਿੱਚ ਹੋਰ ਕਾਫੀ ਘਟਨਾ ਹੁੰਦੀਆਂ ਰਹਿੰਦੀਆਂ ਹਨ ਜੋ ਅਸੀਂ ਇੱਕ ਮਨੁੱਖੀ ਅੱਖ ਨਾਲ ਨਹੀਂ ਦੇਖ ਸਕਦੇ ਇਸ ਤੋਂ ਅਕਾਸ਼ੀ ਘਟਨਾ ਨਾਲ ਸੰਬੰਧਿਤ ਧੂਮ ਕੇਤੂ ਵੀ ਕਾਫੀ ਮਹੱਤਪੂਰਨ ਘਟਨਾ ਦਾ ਇੱਕ ਸੰਕੇਤ ਹੁੰਦਾ ਹੈ ਅਕਾਸ਼ੀ ਘਟਨਾ ਨੂੰ ਦੇਖਿਆ ਜਾ ਸਕਦਾ ਹੈ ਜ਼ਿਆਦਾਤਰ ਜਿਵੇਂ ਇੱਕ ਤਾਰਾ ਟੁੱਟਦਾ ਹੈ ਅਤੇ ਨੀਚੇ ਨੂੰ ਆਉਂਦਾ ਦਿੱਖਦਾ ਹੈ ਪਰ ਉਹ ਇਹ ਕਿ ਅਕਾਸ਼ ਦੇ ਵਿੱਚ ਤਾਰਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਸੂਰਜ ਵੀ ਇੱਕ ਗ੍ਰਹਿਣ ਹੈ ਅਤੇ ਅਕਾਸ਼ ਚੰਦਰਮਾ ਵੀ ਇੱਕ ਗ੍ਰਹਿਣ ਹੈ